ਭਾਰਤ ਦੀ ਸਿੱਖਿਆ ਪ੍ਰਣਾਲੀ ਬਹੁਤ ਵਧੀਆ ਜੀ ਪਰ ਇਹਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਵੇਂ ਕਿ ਗ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹ ਵਧੀਆ ਸਕੂਲਾਂ ਵਿੱਚ ਕੋਨਵੈਂਟ ਸਕੂਲਾਂ ਵਿੱਚ ਜਾਂ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਪੜ੍ਹ ਸਕਦੇ ਸਰਕਾਰੀ ਸਕੂਲ ਹਰ ਜਗ੍ਹਾ ਅਵੇਲੇਵਲ ਨਹੀਂ ਹੈਗੇ ਜੇ ਹੈਗੇ ਤਾਂ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ ਕਿਉਂਕਿ ਉੱਥੇ ਬੱਚੇ ਮਿਹਨਤੀ ਜ਼ਿਆਦਾ ਹੁੰਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਕਈ ਵਾਰ ਟਿਊਸ਼ਨ ਰੱਖਣ ਦੇ ਵਿੱਚ ਦਿੱਕਤ ਆਉਂਦੀ ਹੈ ਉਹਨਾਂ ਨੂੰ ਘਰ ਦੇ ਵਿੱਚ ਵੀ ਉਹਨਾਂ ਦੇ ਪੇਰੈਂਟਸ ਪੜ੍ਹਾਉਣ ਵਾਲੇ ਨਹੀਂ ਹੁੰਦੇ ਮਾਤਾ ਪਿਤਾ ਉਹ ਵੀ ਵਿਚਾਰੇ ਦਿਹਾੜੀ ਮਜ਼ਦੂਰੀ ਕ ਕਰਦੇ ਨੇ ਅਤੇ ਉਹ ਆਪਣੀ ਦਿਹਾੜੀ ਮਜ਼ਦੂਰੀ ਕਰਦੇ ਹੋਏ ਆਪਣੇ ਬੱਚਿਆਂ ਦਾ ਓਨਾਂ ਧਿਆਨ ਨਹੀਂ ਰੱਖ ਸਕਦੇ ਅਤੇ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਵੀ ਨਹੀਂ ਲਗਾ ਸਕਦੇ ਕਿਉਂਕਿ ਘਰਾਂ ਦੇ ਖਰਚੇ ਵੀ ਬਹੁਤ ਜ਼ਿਆਦਾ ਹੁੰਦੇ ਨੇ ਜਾਂ ਤਾਂ ਘਰਾਂ ਦੇ ਖਰਚੇ ਹੋਣਗੇ ਜਾਂ ਤਾਂ ਬੱਚਿਆਂ ਦੀ ਪੜ੍ਹਾਈ ਹੋਵੇਗੀ ਅਤੇ ਜਿਹੜੇ ਸਕੂਲ ਨੇ ਉਹ ਬਹੁਤ ਦੂਰ ਹ ਦੂਰ ਹੁੰਦੇ ਨੇ ਜੀ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਕਈ ਪਿੰਡਾਂ ਵਿੱਚ ਬਹੁਤ ਵਧੀਆ ਸਰਕਾਰੀ ਸਕੂਲ ਨੇ ਪਰ ਸਾਰੇ ਪਿੰਡਾਂ ਵਿੱਚ ਵਧੀਆ ਸਰਕਾਰੀ ਸਕੂਲ ਨਹੀਂ ਦੂਰ ਦੂਰ ਨੇੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਬੱਚਿਆ ਨੂੰ ਦਿੱਕਤ ਆਉਂਦੀ ਹੈ ਇਸੇ ਤਰ੍ਹਾਂ ਜਿਹੜੇ ਕੋਲਜਾਂ ਦੇ ਕੋਲਜ ਵੀ ਬੈਸਟ ਕੋਲਜ ਉਹ ਦੂਰ ਦੂਰ ਨੇ ਅਤੇ ਬੱਚਿਆਂ ਨੂੰ ਸਵੇਰੇ ਟਰੈਵਲਿੰਗ ਕਰਨੀ ਪੈਂਦੀ ਹੈ ਸ਼ਾਮ ਨੂੰ ਜਾ ਕੇ ਖੇਤੀ ਕਰਨੀ ਪੈਂਦੀ ਹੈ ਕਈ ਬੱਚੇ ਖੇਤੀਬਾੜੀ ਵਾਲੇ ਨੇ ਕਈ ਬੱਚੇ ਮਜ਼ਦੂਰੀ ਕਰਦੇ ਨੇ ਅਤੇ ਇਸੇ ਤਰ੍ਹਾਂ ਜਿਹੜੇ ਪ੍ਰਾਈਵੇਟ ਕੋਲਜ ਹਨ ਜਾਂ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਵੀ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਤਾ ਪਿਤਾ ਵੀ ਡਬਲ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਜਿਹਦੇ ਕਰਕੇ ਬੱਚਿਆਂ ਨੂੰ ਉਸ ਤਰ੍ਹਾਂ ਦੀ ਪੜ੍ਹਾਈ ਨਹੀਂ ਮਿਲ ਸਕਦੀ ਜਿਸ ਤਰ੍ਹਾਂ ਦੀ ਇੱਕ ਵਧੀਆ ਸਕੂ ਕੋਲਜ ਜਾਂ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੂੰ ਮਿਲਦੀ ਹੈ